ਹਾਂ ਮੈਂ ਟਰੈਕਿੰਗ ਸਮੂਹਾਂ ਦੇ ਪ੍ਰਬੰਧ ਵਿੱਚ ਹਾਂ ਇੰਡੀਆ ਦੇ ਵਿੱਚ ਕਈ ਟਰੈਕਿੰਗ ਕੰਪਨੀਆਂ ਹਨ ਜਿਵੇਂ ਕਿ ਇੰਡੀਆ ਦਾ ਹਿਮਾਲਿਆਸ ਥੀਲੋਫਿਲਾ ਜਾਂ ਹੋਰ ਵੀ ਕਹੀ ਪ੍ਰਾਈਵੇਟ ਕੰਪਨੀਆਂ ਹਨ ਮੈਂ ਹਮੇਸ਼ਾਂ ਟਰੈਕਿੰਗ ਕੰਪਨੀ ਰਾਹੀਂ ਹੀ ਜਾਣਾ ਪਸੰਦ ਕਰਦਾ ਹਾਂ ਕਿਉਂਕਿ ਉਹ ਸਾਰਾ ਕੁਝ ਆਪ ਆਪਣੇ ਆਪ ਔਰਗਨਾਈਜ਼ ਕਰਦੇ ਹਨ ਸਾਰਾ ਸਵੀਪਿੰਗ ਦਾ ਸਮਾਨ ਸਾਰਾ ਕਿਚਨ ਦਾ ਸਮਾਨ ਸਭ ਕੁਝ ਉਹ ਆਪ ਪ੍ਰਬੰਧ ਕਰਦੇ ਹਨ ਜੇ ਮੈਂ ਆਪ ਟਰੈਕ ਕਰਦਾ ਹਾਂ ਤਾਂ ਮੈਨੂੰ ਸਾਰਾ ਸਮਾਨ ਖੁਦ ਚੱਕਣਾ ਪੈਂਦਾ ਹੈ ਜਿਹਦੇ ਨਾਲ ਵੇਟ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਇੰਨਾਂ ਵੇਟ ਚੱਕਣਾ ਸੰਭਵ ਨਹੀਂ ਹੈ ਟਰੈਕਿੰਗ ਕੰਪਨੀ ਦੇ ਨਾਲ ਇੱਕ ਟਰੈਕ ਗਾਈਡ ਹੁੰਦਾ ਹੈ ਦੋ ਟਰੈਕ ਲੀਡ ਹੁੰਦੇ ਹਨ ਪੰਜ ਸੱਤ ਕਿਚਨ ਦੇ ਬੰਦੇ ਹੁੰਦੇ ਹਨ ਜੋ ਕਿ ਸਾਰਾ ਸਮਾਨ ਕੈਰੀ ਕਰਦੇ ਹਨ ਉਸ ਸਥਾਨ ਤੋਂ ਪਹੁੰਚਣ ਤੋਂ ਪਹਿਲਾਂ ਸਾਡੇ ਟੈਂਟ ਲੱਗੇ ਹੁੰਦੇ ਹਨ ਤਾਂ ਟਰੈਕਿੰਗ ਕੰਪਨੀ ਨਾਲ ਟਰੈਕ ਕਰਨਾ ਬਹੁਤ ਇਜ਼ੀ ਹੋ ਜਾਂਦਾ ਹੈ ਤਾਂ ਮੇਰਾ ਮੇਨ ਮੋਡ ਆਫ ਕਮਿਊਨੀਕੇਸ਼ਨ ਤਾਂ ਟਰੈਕ ਕੰਪਨੀਆਂ ਹੀ ਹੁੰਦੀਆਂ ਹਨ ਬਟ ਕਈ ਵਾਰ ਮੈਨੇ ਖੁਦ ਵੀ ਟਰੈਕ ਕੀਤੇ ਹਨ ਜੋ ਬਹੁਤ ਔਖੇ ਲੱਗੇ ਮੈਨੂੰ ਕਿਉਂਕਿ ਸਮਾਨ ਬਹੁਤ ਚੱਕਣਾ ਪੈਂਦਾ ਸੀ ਇਸ ਕਰਕੇ ਮੈਂ ਹਰ ਵਾਰੀ ਇੰਡੀਆ ਹਾਈਕਸ ਵਰਗੀ ਕੰਪਨੀ ਨਾਲ ਜਾਣਾ ਪਰ ਪਰੈਫਰ ਕਰਦਾ ਹਾਂ ਇੰਡੀਆ ਹਾਈਕਸ ਦੇ ਵਿੱਚ ਇੱਕ ਹੋਰ ਸੁਵਿਧਾ ਹੈ ਜੇ ਕੋਈ ਵੀ ਤੁਸੀਂ ਟਰੈਕ ਇੱਕ ਵਾਰ ਕਰ ਲੈਂਦੇ ਹੋ ਤਾਂ ਉਹ ਪੂਰੀ ਜ਼ਿੰਦਗੀ ਲਈ ਤੁਹਾਡੇ ਲਈ ਫਰੀ ਹੋ ਜਾਂਦਾ ਹੈ ਇਹ ਇੱਕ ਹੋਰ ਬੈਨੀਫਿਟ ਹੈ ਜਿਸ ਕਰਕੇ ਮੈਂ ਟਰੈਕਿੰਗ ਕੰਪਨੀਆਂ ਨੂੰ ਚੂਜ ਕਰਦਾ ਹਾਂ ਅਤੇ ਟਰੈਕਿੰਗ ਕੰਪਨੀਆਂ ਕੋਲ ਕਈ ਸਾਧਨ ਵੀ ਹੁੰਦੇ ਹਨ ਜਿਵੇਂ ਕਿ ਜੇ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸ ਬੰਦੇ ਨੂੰ ਕਿਵੇਂ ਠੀਕ ਕਰਨਾ ਹੈ ਆਕਸੀਜਨ ਸਿਲਿੰਡਰ ਵਗੈਰਾ ਕਾਫੀ ਚੀਜ਼ਾਂ ਹੁੰਦੀਆਂ ਹਨ ਤਾਂ ਮੈਂ ਹਮੇਸ਼ਾ ਹੀ ਟਰੈਕ ਕੰਪਨੀਆਂ ਨਾਲ ਜਾਣਾ ਪ੍ਰੈਫਰ ਕਰਦਾ ਹਾਂ ਮੇਰਾ ਪਿਛਲਾ ਟਰੈਕ ਜੂਨ ਦੇ ਵਿੱਚ ਬਾਲੀਪਾਸ ਸੀ ਜੋ ਕਿ ਦਸ ਦਿਨ ਦਾ ਟਰੈਕ ਸੀ ਉਹ ਵੀ ਮੈਂ ਇੰਡੀਆ ਹਾਈਕਸ ਨਾਲ ਹੀ ਕੀਤਾ ਉਹ ਅਤੇ ਉਹਦਾ ਐਕਸਪੀਰੀਅੰਸ ਵੀ ਬਹੁਤ ਵਧੀਆ ਸੀ ਮੈਂ ਉਹ ਇਕੱਲਾ ਟਰੈਕ ਨਾ ਕਰ ਪਾਉਂਦਾ ਜੇ ਬਿਨਾਂ ਕਿਸੇ ਕੰਪਨੀ ਤੋਂ ਜਾਂਦਾ ਤਾਂ ਮੈਂ ਵੀ ਪ੍ਰੈਫਰ ਕਰਾਂਗਾ ਜੇ ਕੋਈ ਵੀ ਜਾਂਦਾ ਹੈ ਤਾਂ ਇੰਡੀਆ ਹਾਈਕਸ ਵਰਗੀ ਕੰਪਨੀ ਜਾਂ ਹੋਰ ਕਿਸੇ ਪ੍ਰੋਫੈਸ਼ਨਲ ਏਜੰਸੀ ਨਾਲ ਹੀ ਜਾਣਾ ਚਾਹੀਦਾ ਹੈ ਉਹਨਾਂ ਤੋਂ ਬਿਨਾਂ ਜਾਣ ਦੇ ਵਿੱਚ ਬਹੁਤ ਡਰ ਹੈ ਪਰਮਿਸ਼ਨ ਨਹੀਂ ਮਿਲੇਗੀ ਫੋਰਿਸਟ ਪਰਮਿਸ਼ਨ ਮਿਲਣੀ ਬਹੁਤ ਔਖੀ ਹੈ ਫੋਰਿਸਟ ਪਰਮਿਸ਼ਨ ਲੈਣ ਲਈ ਸਾਨੂੰ ਇੱਕ ਤੁਹਾਡੇ ਨਾਲ ਹੋਣਾ ਜ਼ਰੂਰੀ ਹੈ ਤਾਂ ਹਮੇਸ਼ਾ ਧਿਆਨ ਰੱਖੋ ਵੀ ਤੁਸੀਂ ਪੂਰੇ ਡਾਕੂਮੈਂਟ ਕਰਕੇ ਜਾਓ ਜੇ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈ ਫੋਰਿਸਟ ਗਾਰਡ ਨੇ ਤੁਹਾਨੂੰ ਫੜ ਲਿਆ ਤਾਂ ਤੁਹਾਨੂੰ ਜੇਲ ਵੀ ਹੋ ਸਕਦੀ ਹੈ ਕੁਛ ਮਹੀਨਿਆਂ ਲਈ ਅਤੇ ਇਹ ਟਰੈਕਿੰਗ ਕੰਪਨੀਆਂ ਬਿਨਾਂ ਫੋਰਿਸਟ ਪਰਮੀਸ਼ਨ ਤੋਂ ਟਰੈਕ ਨਹੀਂ ਕਰਵਾਉਂਦੀਆਂ ਤਾਂ ਇੱਕ ਹੋਰ ਚੰਗੀ ਗੱਲ ਹੈ ਇਹਨਾਂ ਨਾਲ ਟਰੈਕ ਕਰਨ ਦੀ ਧੰਨਵਾਦ